ਧੰਨਵਾਦ ਅੰਕਲ ਤੁਸੀਂ ਮੈਨੂੰ ਅੱਜ ਪੂਰੇ ਸਹੀ ਵਕਤ 'ਤੇ ਇੱਥੇ ਪੁਜਾ ਦਿੱਤਾ ਹੈ ਜੇ ਅੱਜ ਤੁਸੀਂ ਮੇਰਾ ਫੋਨ ਸਹੀ ਵਕਤ 'ਤੇ ਨਾ ਉਠਾਉਂਦੇ ਤਾਂ ਮੈਂ ਮੇਰਾ ਅੱਜ ਐਸ ਐਸ ਸੀ ਦਾ ਪੇਪਰ ਰਹਿ ਜਾਣਾ ਸੀ ਮੈਂ ਤੁਹਾਨੂੰ ਦੱਸਦਾ ਕਿ ਇਹ ਮੇਰਾ ਅੱਜ ਇਸ ਵਾਰ ਲਾਸਟ ਮੌਕਾ ਸੀ ਜੇ ਇਹ ਖੁੰਝ ਜਾਂਦਾ ਤਾਂ ਮੈਂ ਰਹਿ ਜਾਣਾ ਸੀ ਅਤੇ ਮੈਨੂੰ ਬਹੁਤ ਹੀ ਪਛਤਾਵਾ ਹੋਣਾ ਸੀ ਤੁਹਾਡੇ ਕਰਕੇ ਹੀ ਅੱਜ ਮੈਂ ਆਪਣਾ ਪੇਪਰ ਦੇ ਪਾਵਾਂਗੀ ਅੰਕਲ ਮੈਨੂੰ ਦੱਸ ਦਿਓ ਮੇਰੇ ਕਿੰਨੇ ਪੈਸੇ ਬਣੇ ਤਾਂ ਕਿ ਮੈਂ ਪੇਪਰ ਦੇਣ ਲਈ ਜਾ ਸਕਾਂ ਬਟ ਅੰਕਲ ਮੇਰਾ ਅੱਜ ਮੈਂ ਜਲਦੀ ਜਲਦੀ 'ਚ ਆਉਣ ਦੇ ਚੱਕਰ ਵਿੱਚ ਆਪਣੇ ਪੈਸੇ ਘਰ ਹੀ ਭੁੱਲ ਗਈ ਹਾਂ ਇਸ ਕਰਕੇ ਮੈਂ ਤੁਹਾਨੂੰ ਪੇਮੈਂਟ ਯੂ ਪੀ ਆਈ ਦੇ ਰਾਹੀਂ ਦਵਾ ਕਰ ਸਕਾਂਗੀ ਜਾਂ ਫਿਰ ਜੇ ਤੁਸੀਂ ਗੂਗਲ ਪੇ ਪੇਟੀਐਮ ਜਾਂ ਕੋਈ ਹੋਰ ਔਨਲਾਈਨ ਪਲੇਟਫਾਰਮ ਚਲਾਉਂਦੇ ਹੋ ਤਾਂ ਮੈਂ ਉਸ ਦੇ ਰਾਹੀਂ ਤੁਹਾਨੂੰ ਪੇਮੈਂਟ ਤੁਹਾਡੀ ਦੇ ਦਿੰਦੀ ਤੁਸੀਂ ਇਹ ਨਾ ਸਮਝਿਓ ਕਿ ਮੈਂ ਤੁਹਾਨੂੰ ਜਾਣ ਬੁਝ ਕੇ ਟਾਲ ਮਟੋਲ ਕਰ ਰਹੀ ਹਾਂ ਇੱਦਾਂ ਦਾ ਕੁਛ ਵੀ ਨਹੀਂ ਹੈ ਮੈਂ ਜਲਦੀ 'ਚ ਆਉਣਾ ਸੀ ਇਸ ਕਰਕੇ ਭੁੱਲ ਗਈ ਮੈਨੂੰ ਤੁਹਾਡੇ ਸਰਵਿਸ ਵੀ ਬਹੁਤ ਲੱਗਿਆ ਤੁਹਾਡੀ ਗੱਡੀ ਚਲਾਉਣ ਦਾ ਤਰੀਕਾ ਬਹੁਤ ਹੀ ਵਧੀਆ ਸੀ ਇਕਦਮ ਤੁਸੀਂ ਬੇਸ਼ੱਕ ਤੇਜ਼ ਗੱਡੀ ਚਲਾਈ ਪਰ ਤੁਹਾਡਾ ਮਹਿਸੂਸ ਨਹੀਂ ਹੋਇਆ ਮੈਨੂੰ ਬਹੁਤ ਹੀ ਵਧੀਆ ਲੱਗਿਆ ਅਤੇ ਜਿਹੜਾ ਤੁਸੀਂ ਪਾਣੀ ਰਿਫਰੈਸ਼ਨ ਰਿਫਰੈਸ਼ਮੈਂਟ ਰੱਖੀ ਸੀ ਗੱਡੀ ਵਿੱਚ ਉਹ ਵੀ ਬਹੁਤ ਹੀ ਵਧੀਆ ਸੀ ਇਸ ਕਰਕੇ ਤੁਸੀਂ ਮੈਨੂੰ ਗਲਤ ਨਾ ਸਮਝਿਓ ਮੈਂ ਔਨਲਾਈਨ ਪੇਮੈਂਟ ਕਰ ਕਰ ਸਕਾਂਗੀ ਮੈਨੂੰ ਇਸ ਮਾ ਮਾਫ਼ ਕਰਿਓ